ਪੋਲਟਰੀ ਕਾਰੋਬਾਰ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਆਮ ਜਾਂ ਉਸ ਬਿਮਾਰੀ ਨਾਲ ਜੂਝਦੇ ਹਨ ਅਤੇ ਨਾਲ ਆਮ ਜਨਤਾ ਵੀ ਉਸ ਸਮੱਸਿਆ ਵਿੱਚ ਪੈ ਜਾਂਦੀ ਹੈ ਪੋਲਟਰੀ ਕਾਰੋਬਾਰ ਵਿੱਚ ਸਭ ਤੋਂ ਪਹਿਲਾਂ ਉਸਦੀ ਸਾਂਭ ਸੰਭਾਈ ਦਾ ਧਿਆਨ ਰੱਖਿਆ ਜਾਂਦਾ ਹੈ ਨਾਈਨਟੀ ਨਾਈਨ ਪਰਸਨ ਵਲਡ ਫਲੂ ਪੰਜਾਬ ਵਿੱਚ ਹੀ ਪਾਇਆ ਜਾਂਦਾ ਹੈ ਅਗਰ ਟਾਈਮ ਟਾਈਮ 'ਤੇ ਸਮੇਂ 'ਤੇ ਚੈਕਅਪ ਕੀਤਾ ਜਾਵੇ ਟੀਕਾਕਰਨ ਸਹੀ ਦਿੱਤਾ ਜਾਵੇ ਤਾਂ ਕਿ ਇਹ ਸਮੱਸਿਆ ਪੈਦਾ ਹੀ ਨਾ ਹੋਵੇ ਕਿਹੜੀ ਕਿਹੜੀ ਸਮੱਸਿਆ ਹੈ ਜਿਹੜੀ ਪੋਲਟਰੀ ਫਾਰਮ ਵਿੱਚ ਆਮ ਜਾਨਵਰਾਂ ਵਿੱਚ ਨੂੰ ਦੇਖਣ ਵਿੱਚ ਆਉਂਦੀ ਹੈ ਕਿਹੜੀਆਂ ਕਿਹੜੀਆਂ ਬਿਮਾਰੀਆਂ ਹਨ ਇੱਕ ਤਾਂ ਰਾਣੀ ਖੇਤਰੋਗ ਹੈ ਫੈਟੀ ਲੀਵਰ ਸਿਡੋਰਮ ਰਾਣੀ ਖੇਦੀ ਬਿਮਾਰੀ ਨਿਊ ਕੈਸ਼ਲ ਬਿਮਾਰੀ ਇਹ ਇੱਕ ਵਾਇਰਲ ਬਿਮਾਰੀ ਬਹੁਤ ਜ਼ਿਆਦਾ ਫੈਲਦੀ ਹੈ ਹਰ ਉਮਰ ਦਾ ਬੰਦਾ ਇਸ ਤੋਂ ਪ੍ਰਭਾਵਿਤ ਹੁੰਦਾ ਹੈ ਇਹ ਇੱਕ ਛੂਆ ਛਾਤ ਵਾਲੀ ਬਿਮਾਰੀ ਹੈ ਇਸ ਵਿੱਚ ਇੱਕ ਪਰਸਨ ਨੂੰ ਹੋ ਕੇ ਦੂਜੇ ਪਰਸਨ ਤੱਕ ਬਹੁਤ ਤੇਜ਼ੀ ਦੇ ਨਾਲ ਇਹ ਬਿਮਾਰੀ ਫੈਲਦੀ ਹੈ ਇਸ ਵਿੱਚ ਸਾਹ ਲੈਣ ਦੀ ਪ੍ਰੋਬਲਮ ਆਉਂਦੀ ਹੈ ਅੰਡੇ ਦਾ ਉਪਾਅ ਜਿਹੜਾ ਹੈ ਘਟਨਾ ਸ਼ਾਮਲ ਹੋ ਜਾਂਦਾ ਹੈ ਉਸ ਦਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ ਸਾਨੂੰ ਕੀ ਹੈ ਉਸਦੀ ਸਾਫ਼ ਸੰਭਾਈ ਵੱਲ ਧਿਆਨ ਰੱਖਣਾ ਚਾਹੀਦਾ ਹੈ ਰੋਗਾਣੂ ਮੁਕਤ ਕਰਨਾ ਪਵੇਗਾ ਉਹ ਏਰੀਆ ਤਾਂ ਹੀ ਆਪਾਂ ਵੱਧ ਤੋਂ ਵੱਧ ਕਰ ਸਕਦੇ ਹਾਂ ਉਹਨੂੰ ਠੀਕ